ਮੋਹਾਲੀ ਜ਼ਿਲ੍ਹਾ ਇੱਕ ਬਹੁਤ ਹੀ ਵੱਡਾ ਜ਼ਿਲ੍ਹਾ ਹੈ ਇਸ ਦੇ ਆਸ ਪਾਸ ਕਈ ਪਿੰਡ ਹਨ ੲ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਲੋਕ ਬਾਹਰੋਂ ਆਏ ਹੋ ਆਏ ਹੋਏ ਹਨ ਜੋ ਕਿ ਇੱਥੇ ਨੌਕਰੀਆਂ ਕਰਦੇ ਹਨ ਅਤੇ ਕੁਝ ਬੱਚੇ ਪੜ੍ਹਾਈ ਲਈ ਆਏ ਹੋਏ ਹਨ ਬਾਹਰ ਦੇ ਲੋਕਾਂ ਦਾ ਪਹਿਰਾਵਾ ਬਿਲਕੁਲ ਹੀ ਇੱਥੋਂ ਦੇ ਪਹਿਰਾਵੇ ਨਾਲੋਂ ਅਲੱਗ ਹੈ ਉਹਨਾਂ ਦਾ ਖਾਣ ਪੀਣ ਦਾ ਢੰਗ ਵੀ ਇੱਥੋਂ ਨਾਲੋਂ ਵੱਖਰਾ ਹੈ ਉਹਨਾਂ ਦੀ ਬੋਲੀ ਅਲੱਗ ਹੀ ਹੈ ਜੋ ਕਿ ਕਈ ਵਾਰ ਸਮਝਣ ਦੇ ਬਿਲਕੁਲ ਹੀ ਯੋਗ ਨਹੀਂ ਹੈ ਇਹਨਾਂ ਨਾਲ ਇੰਨਾ ਕੁਛ ਹੋਣ ਤੋਂ ਬਾਅਦ ਵੀ ਮੋਹਾਲੀ ਵਿੱਚ ਭਾਈਚਾਰੇ ਭਾਈਚਾਰਾ ਬਹੁਤ ਹੈ